ਸਾਡੇ ਇੱਥੇ ਹਿੰਦੂ ਸਿੱਖ ਮੁਸਲਿਮ ਇਸਾਈ ਵੀਰ ਸਾਰੇ ਧਰਮਾਂ ਦੇ ਜੋ ਵੀ ਰਹਿੰਦੇ ਹਨ ਸਭ ਇੱਕ ਦੂਜੇ ਨਾਲ ਰਲ ਮਿਲ ਕੇ ਇਕੱਠੇ ਹੋ ਕੇ ਪਿਆਰ ਸਤਿਕਾਰ ਨਾਲ ਰਹਿ ਰਹੇ ਹਨ ਜੋ ਵੀ ਮੁਸਲਮਾਨ ਵੀਰ ਆਪਣਾ ਈਦ ਦਾ ਤਿਉਹਾਰ ਮਨਾਉਂਦੇ ਹਨ ਬਾਕੀ ਸਾਰਾ ਭਾਈਚਾਰਾ ਵੀ ਅਸੀਂ ਸਿੱਖ ਵੀ ਉਹਨਾਂ ਦੇ ਨਾਲ ਰਲ ਕੇ ਉਹਨਾਂ ਦੇ ਈਦ ਦੇ ਤਿਉਹਾਰ ਵਿੱਚ ਉਹਨਾਂ ਨੂੰ ਵਧਾਈਆਂ ਦੇ ਕੇ ਨਾਲ ਸ਼ਰੀਕ ਬਣਾਉਂਦੇ ਹਾਂ